ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲੋਕ ਆਪਣੇ ਸੱਭਿਆਚਾਰਕ ਪਰ ਪਰੰਪਰਾਵਾਂ ਨੂੰ ਮਨਾਉਣ ਲਈ ਸਨਮਾਨ ਦੇਣ ਲਈ ਇੱਕ ਭਾਸ਼ਾ ਦੀ ਵਰਤੋਂ ਕੁਝ ਇਸ ਤਰੀਕੇ ਨਾਲ਼ ਕਰਦੇ ਹਨ ਜਿਵੇਂ ਕਿ ਦੇਖਿਆ ਜਾਵੇ ਤਾਂ ਸਾਡਾ ਪੰਜਾਬ ਦਾ ਸੱਭਿਆਚਾਰ ਜੋ ਉਹ ਹੈ ਭੰਗੜਾ ਗਿੱਧਾ ਝੂਮਰ ਉਸ ਵਿੱਚ ਆਪਾਂ ਕੁਝ ਇਸ ਪ੍ਰਕਾਰ ਕਰਦੇ ਹਾਂ ਜਿਵੇਂ ਪੰਜਾਬੀ ਭਾਸ਼ਾ ਵਿੱਚ ਬੋਲੀਆਂ ਪਾਉਂਦੇ ਹਾਂ ਇੱਕ ਦੂਜੇ ਨੂੰ ਜੀ ਕਰਕੇ ਬੁਲਾਉਂਦੇ ਹਾਂ ਮਖੌਲ ਕਰਦੇ ਹਾਂ ਜਿੱਦਾਂ ਪੰਜਾਬ ਵਿੱਚ ਬੜਾ ਹੀ ਇੱਕ ਵਧੀਆ ਤਿਉਹਾਰ ਆਉਂਦਾ ਹੈ ਜਿਹੜਾ ਕਿ ਤੀਆਂ ਦਾ ਤਿਉਹਾਰ ਹੈ ਜਿਸ ਵਿੱਚ ਧੀਆਂ ਆਪਣੇ ਘਰ ਵਿੱਚ ਆਉਂਦੀਆਂ ਹਨ ਅਤੇ ਪੀਂਘਾਂ ਝੂਟਦੀਆਂ ਹਨ ਬੋਲੀਆਂ ਪਾਉਂਦੀਆਂ ਹਨ ਅਤੇ ਸ਼ਿੰਗਾਰ ਵੀ ਕਰਦੀਆਂ ਹਨ ਅਤੇ ਆਪਣੇ ਦਿਨ ਜਿਹੜਾ ਬੜੇ ਹੀ ਚੰਗੇ ਤਰੀਕੇ ਨਾਲ਼ ਲੰਘਾਉਂਦੀਆਂ ਹਨ ਮੌਜਾਂ ਕਰਦੀਆਂ ਹਨ ਬੋਲੀਆਂ ਪਾਉਂਦੀਆਂ ਹਨ ਅਤੇ ਹੋਰ ਵੀ ਦੁੱਖ ਸੁੱਖ ਸਾਂਝੇ ਕਰਦੀਆਂ ਹਨ ਅਤੇ ਤਿਉਹਾਰ ਨੂੰ ਵਧੀਆ ਬਣਾਉਂਦੀਆਂ ਹਨ ਦਰਖ਼ਤ ਦੀ ਟਾਹਣੀ ਦੇ ਨਾਲ਼ ਪੀਂਘ ਲਗਾ ਕੇ ਪੀਂਘਾਂ ਵੀ ਝੂਟਦੀਆਂ ਹਨ ਅਤੇ ਆਪਣੇ ਆਪ ਨੂੰ ਤਿਆਰ ਕਰਕੇ ਘੁੰਮਣ ਜਾਂਦੀਆਂ ਹਨ ਅਤੇ ਸਾਰੀਆਂ ਸਹੇਲੀਆਂ ਇਕੱਠੀਆਂ ਰਹਿੰਦੀਆਂ ਹਨ ਪੰਜਾਬੀ ਭਾਸ਼ਾ ਵਿੱਚ ਹਰ ਇੱਕ ਨੂੰ ਹਰ ਇੱਕ ਨੂੰ ਕਰਕੇ ਜੀ ਕਰਕੇ ਬੁਲਾਇਆ ਜਾਂਦਾ ਹੈ ਭਾਵੇਂ ਵੱਡਾ ਹੋਵੇ ਅਤੇ ਭਾਵੇਂ ਛੋਟਾ ਹੋਵੇ ਅਮੀਰ ਹੋਵੇ ਭਾਵੇਂ ਗਰੀਬ ਹੋਵੇ ਇਸ ਪੰਜਾਬੀ ਤਰੀਕੇ ਨਾਲ਼ ਸੱਭਿਆਚਾਰਕ ਪੰਜਾਬੀ ਬੋਲੀ ਸ ਪ੍ਰਭਾਵ ਪਰੰਪਰਾਵਾਂ ਨੂੰ ਮਨਾਉਂਦੇ ਹੋਏ ਸਨਮਾਨ ਦਿੰਦੇ ਹਨ ਧੰਨਵਾਦ ਜੀ